ਕੁਝ ਸਥਾਨਿਕ ਕਹਾਣੀਆਂ ਜਾਂ ਕਥਾਵਾਂ ਜੋ ਪਟਿਆਲੇ ਜਿਲ੍ਹੇ ਵਿੱਚ ਜਾਣੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ ਇੱਕ ਹੈ ਮਹਾਰਾਜਾ ਪਟਿਆਲਾ ਦੀ ਕਿ ਪਟਿਆਲਾ ਜਿਲ੍ਹੇ ਦਾ ਨਾਮ ਮਹਾਰਾਜਾ ਆਲਾ ਸਿੰਘ ਦੇ ਨਾਮ 'ਤੇ ਪਿਆ ਆਲਾ ਸਿੰਘ ਦੇ ਨਾਮ ਤੋਂ ਇਸ ਸਥਾਨ ਨੂੰ ਆਲਾ ਸਿੰਘ ਵਾਲਾ ਅਤੇ ਹੌਲੀ ਹੌਲੀ ਬਦਲਦਾ ਬਦਲਦਾ ਪਟਿਆਲਾ ਹੋ ਗਿਆ ਪਟਿਆਲਾ ਜਿਲ੍ਹਾ ਵਿੱਚ ਬਹੁਤ ਸਾਰੇ ਸਥਾਨ ਵੇਖਣ ਵਾਲੇ ਜੋਰਾਂ ਵਾਲੇ ਹਨ ਪਟਿਆਲੇ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਿਕ ਥਾਵਾਂ ਹਨ ਜਿਹਨਾਂ ਬਾਰੇ ਲੋਕਾਂ ਨੂੰ ਹਜੇ ਬਹੁਤ ਹੀ ਘੱਟ ਪਤਾ ਹੈ ਜਿਹਨਾਂ ਵਿੱਚੋਂ ਮੋਤੀ ਬਾਗ ਸ਼ੀਸ਼ ਮਹਿਲ ਦੁਖਨਿਵਾਰਨ ਸਾਹਿਬ ਗੁਰਦੁਆਰਾ ਵੀ ਹੈ ਮੋਤੀ ਬਾਗ ਅਤੇ ਸ਼ੀਸ਼ ਮਹਿਲ ਰਾਜੇ ਦੇ ਪਰਿਵਾਰ ਨਾਲ ਹੀ ਸੰਬੰਧਿਤ ਹਨ ਪਰ ਗੁਰਦੁਆਰਾ ਸਾਹਿਬ ਦੁਖਨਿਵਾਰਨ ਸਾਹਿਬ ਗੁਰ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਬਣਾਇਆ ਹੋਇਆ ਸੀ ਇਸ ਸਥਾਨ 'ਤੇ ਪੰਚਵੀਂ ਵਾਲੇ ਦਿਨ ਬਹੁਤ ਸਾਰੇ ਲੋਕ ਦੂਰ ਦੁਰਾਂਡੇ ਤੋਂ ਪੰਚਵੀਂ ਨਹਾਉਣ ਆਉਂਦੇ ਹਨ ਮੰਨਿਆ ਜਾਂਦਾ ਹੈ ਕਿ ਪੰਜ ਪੰਚਵੀਂਆਂ ਨਹਾਉਣ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਕਈ ਲੋਕਾਂ ਦੇ ਰੋਗ ਵੀ ਦੂਰ ਹੁੰਦੇ ਹਨ ਇਸ ਸ਼ਹਿਰ ਵਿੱਚ ਘੱਗਰ ਨਦੀ ਵੀ ਵਗਦੀ ਹੈ ਜਿਸ ਬਾਰੇ ਧਾਰਨਾ ਹੈ ਕਿ ਇਹ ਕਈ ਵਾਰ ਸ਼ਹਿਰ ਵਿੱਚ ਹੜ੍ਹ ਆਉਣ ਦਾ ਕਾਰਣ ਬਣਦੀਆਂ ਹਨ ਅਤੇ ਜਦੋਂ ਹੜ੍ਹ ਆਪਣੇ ਜੋਰਾਂ 'ਤੇ ਹੁੰਦਾ ਹੈ ਉਸ ਸਮੇਂ ਪਟਿਆਲੇ ਰਾਜਾ ਦੇ ਘਰਾਣੇ ਵਿੱਚੋਂ ਇੱਕ ਔਰਤ ਸੋਨੇ ਦੀ ਇੱਕ ਨੱਥ ਅਤੇ ਚੂੜਾ ਨਦੀ ਨੂੰ ਚੜਾਉਂਦੇ ਹਨ ਜਿਸ ਨਾਲ ਨਦੀ ਆਪਣਾ ਪਾਣੀ ਵਾਪਿਸ ਲੈ ਜਾਂਦੀ ਹੈ ਅਤੇ ਆਮ ਜਨਤਾ ਨੂੰ ਵੀ ਸੁੱਖ ਦਾ ਸਾਹ ਆਉਂਦਾ ਹੈ ਪਟਿਆਲੇ ਜਿਲ੍ਹੇ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਥਾਵਾਂ ਵੇਖਣ ਲਈ ਹਨ ਜਿਹਨਾਂ ਬਾਰੇ ਲੋਕਾਂ ਨੂੰ ਬਹੁਤ ਜਾਣਕਾਰੀ ਹੈ